ਖੇਡਾਂ ਮਹਾਨ ਸਮੋਤਮ ਵਜੋਂ ਖੇਡਾਂ ਉਹ ਹਨ ਜਿਨ੍ਹਾਂ ਵਿੱਚ ਨਾ ਤਾਂ ਕਿਸੇ ਜਾਤ ਪਾਤ ਦਾ ਫਰਕ ਹੁੰਦਾ ਹੈ ਇਹ ਆਪਸ ਵਿੱਚ ਪ੍ਰੇਮ ਹੀ ਵਧਾਉਂਦੀਆਂ ਹਨ ਜੇ ਆਪਾਂ ਕਹੀਏ ਵੀ ਜਿੱਤ ਹਾਰਨਾ ਵੀ ਅੱਜ ਪਾਕਿਸਤਾਨ ਜਿੱਤਿਆ ਇੰਡੀਆ ਹਾਰਿਆ ਹੈ ਇਹ ਸਿਰਫ ਇੱਕ ਆਪਣਾ ਹੀ ਮਨ ਵਿਸ਼ਵਾਸ ਹੈ ਪਰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਾ ਭੇਦਭਾਵ ਨਹੀਂ ਹੈਗਾ ਜੇ ਉਹਨਾਂ ਵਿੱਚ ਪ੍ਰੇਮ ਹੈ ਉਹ ਤਾਂ ਹੀ ਖੇਡਦੇ ਹਨ ਨਾ ਕਿ ਉਹਨਾਂ ਨੂੰ ਕੋਈ ਐਵੇਂ ਵੀ ਹਾਂ ਅਸੀਂ ਪਾਕਿਸਤਾਨ ਵਾਲੇ ਇੰਡੀਆ ਕਨੇਡਾ ਅਮਰੀਕਾ ਕੁਛ ਨਹੀਂ ਹੈ ਐਵੇਂ ਦਾ ਇਹਨਾਂ ਦਾ ਆਪਸ ਦਾ ਪ੍ਰੇਮ ਹੈ ਇਹਦੇ ਵਿੱਚ ਕੋਈ ਧਰਮ ਨਹੀਂ ਆਉਂਦਾ ਕੋਈ ਸਮਾਜਿਕ ਉਹ ਕੁਛ ਨਹੀਂ ਆਉਂਦਾ ਹੈਗਾ